ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਅਠਾਰਾਂ ਜੂਨ ਦੋ ਹਜ਼ਾਰ ਤੇਈ ਦਾ ਵਾਕਿਆ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਅਤੇ ਮੇਰਾ ਮਿੱਤਰ ਰੋਪੜ ਅੱਡੇ ਉੱਤੇ ਖੜ੍ਹੇ ਹੋਏ ਸਾਂ ਸਾਡਾ ਪਟਵਾਰੀ ਦਾ ਪੇਪਰ ਤਕਰੀਬਨ ਦਸ ਵਜੇ ਰਿਆਤ ਬਹਾਰਾ ਯੂਨੀਵਰਸਿਟੀ ਖਰੜ ਵਿਖੇ ਪੈਣਾ ਸੀ ਅਤੇ ਅਸੀਂ ਆਲੇ ਦੁਆਲੇ ਨਜ਼ਰ ਮਾਰੀ ਤਾਂ ਕੋਈ ਵੀ ਆਉਂਦੀ ਬੱਸ ਨਹੀਂ ਦਿਖ ਰਹੀ ਸੀ ਪਰੰਤੂ ਤੁਹਾਡੀ ਸੰਡੀਕੇਟ ਬੱਸ ਉੱਥੇ ਖੜ੍ਹੀ ਹੋਈ ਸੀ ਅਸੀਂ ਉੱਥ ਉਹਦੇ ਅੰਦਰ ਦਾਖਲ ਹੋਏ ਅਤੇ ਉੱਥੇ ਸਾਨੂੰ ਅੰਕਲ ਮਿਲੇ ਡਰਾਈਵਰ ਅੰਕਲ ਨੂੰ ਅਸੀਂ ਆਪਣੀ ਮੁਸ਼ਕਿਲ ਦੱਸੀ ਕਿ ਅਸੀਂ ਤਕਰੀਬਨ ਦਸ ਵਜੇ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਪਹੁੰਚਣਾ ਹੈ ਅਤੇ ਉਨ੍ਹਾਂ ਨੇ ਸਾਡੀ ਗੱਲ ਮੰਨੀ ਅਤੇ ਸਾਨੂੰ ਦਸ ਵਜੇ ਤੋਂ ਤਕਰੀਬਨ ਪੰਦਰਾਂ ਵੀਹ ਮਿੰਟ ਪਹਿਲਾਂ ਹੀ ਉੱਥੇ ਪੁੱਜਾ ਦਿੱਤਾ ਇਸ ਗੱਲ ਲਈ ਅਸੀਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਵਾਂਗੇ ਇਸ ਤੋਂ ਇਲਾਵਾ ਕਿ ਮੇਰੇ ਦੋਸਤ ਦੇ ਪੈਸੇ ਕਿਤੇ ਗਿਰ ਗਏ ਸਨ ਅਤੇ ਉਨ੍ਹਾਂ ਨੇ ਉਹ ਕਿਰਾਇਆ ਵੀ ਉਸ ਨੂੰ ਮਾਫ ਕਰ ਦਿੱਤਾ ਇਸ ਗੱਲ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਹੋਵੇਗਾ